ਸਾਡੇ ਕੋਲ ਲਗਭਗ ਚਾਰ ਮੱਝਾ ਤਿੰਨ ਗਾਈਆਂ ਅਤੇ ਦੋ ਬਕਰੀਆਂ ਹਨ ਅਤੇ ਉਹਨਾਂ ਦੀ ਦੇਖਭਾਲ ਕਰਨ ਦੀ ਪਹਿਲਾਂ ਸਾਨੂੰ ਸੁਬਹਾ ਚਾਰ ਵਜੇ ਉੱਠ ਕੇ ਉਹਨਾਂ ਨੂੰ ਉਹਨਾਂ ਲਈ ਕੱਖ ਕ ਪਾਉਣੇ ਪੈਂਦੇ ਹਨ ਅਤੇ ਅਸੀਂ ਧਾਰਾਂ ਉਹਨਾਂ ਦੀਆਂ ਚੋਂਦੇ ਹਾਂ ਅਤੇ ਫਿਰ ਸੁਬਹਾ ਛੇ ਸੱਤ ਵਜੇ ਅਸੀਂ ਖੇਤਾਂ ਵਿੱਚੋਂ ਉਹਨਾਂ ਲਈ ਕੱਖ ਵੱਢ ਕੇ ਲਿਆਉਂਦੇ ਜਿਵੇਂ ਚਰੀ ਬਾਜਰਾ ਮੱਕੀ ਆਦਿ ਅਤੇ ਉਹਨਾਂ ਨੂੰ ਫਿਰ ਅਸੀਂ ਘਰ ਲਿਆ ਕੇ ਕੁਤਰਦੇ ਹਾਂ ਅਤੇ ਕੁਤਰ ਕੇ ਉਹਨਾਂ ਨੂੰ ਦੁਬਾਰਾ ਪਾਉਂਦੇ ਹਾਂ ਅਤੇ ਲਗਭਗ ਸਵੇਰੇ ਦੱਸ ਕੁ ਵਜੇ ਉਹਨਾਂ ਨੂੰ ਅਸੀਂ ਫਿਰ ਪਾਣੀ ਪਿਲਾਉਂਦੇ ਆ ਅਤੇ ਨਹਾਉਂਦੇ ਹਾਂ ਅਤੇ ਨਹਾ ਕੇ ਉਹਨਾਂ ਨੂੰ ਪੱਖੇ ਥੱਲੇ ਬੰਨਦੇ ਹਾਂ ਅਤੇ ਬੰਨ ਕੇ ਫਿਰ ਤਿੰਨ ਸ਼ਾਮ ਨੂੰ ਫਿਰ ਤਿੰਨ ਢਾਈ ਤਿੰਨ ਵਜੇ ਨਾ ਨੂੰ ਕੱਖ ਪਾਉਂਦੇ ਆ ਅਤੇ ਸ਼ਾਮ ਨੂੰ ਚਾਰ ਪੰਜ ਵਜੇ ਉਹਨਾਂ ਦੀਆਂ ਧਾਰਾਂ ਕੱਢੀਆਂ ਜਾਂਦੀਆਂ ਹਨ ਅਤੇ ਫਿਰ ਉਹਨਾਂ ਨੂੰ ਦੁਬਾਰਾ ਕ ਬਾੜੇ ਵਿੱਚ ਬੰਨ ਦਿੱਤਾ ਜਾਂਦਾ ਹੈ ਅਤੇ ਫਿਰ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹਿੰਦਾ ਹੈ